ਹੈਲੋ ਹਾਂਜੀ ਕੌਣ ਹਾਂਜੀ ਮੈਮ ਰਾਮ ਰਾਮ ਜੀ ਹਾਂਜੀ ਹਾਂਜੀ ਇੱਥੇ ਕਾਫੀ ਡਿਵੈਲਪਮੈਂਟ ਹੋ ਗਿਆ ਜਦੋਂ ਦੀ ਆਮ ਪਾਰਟੀ ਆਈ ਹੈ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੀ ਸਹੂਲਤਾਂ ਪ੍ਰਾਪਤ ਕੀਤੀਆਂ ਲੋਕਾਂ ਨੂੰ ਅਤੇ ਉਹਦੇ ਵਿੱਚ ਜਿਵੇਂ ਬਿਜਲੀ ਫ੍ਰੀ ਹੋ ਗਈ ਆ ਆਹੀ ਛੇ ਸੌ ਵੌਟ ਤੱਕ ਉਹਨੂੰ ਕਰ ਸਕਦੇ ਹਾਂ ਯੂਸ ਅਤੇ ਹੋਰ ਵੀ ਕਈ ਸਹੂਲਤਾਂ ਨੇ ਜਿਵੇਂ ਟ੍ਰੈਫਿਕ ਦੀ ਜਿਹੜੀ ਪੁਲਿਸ ਸੀ ਉਹ ਪਹਿਲਾਂ ਕੋਈ ਕੰਮ ਨਹੀਂ ਕਰਦੇ ਸੀ ਹੁਣ ਉਹਨਾਂ ਨੇ ਹਰ ਟ੍ਰੈਫਿਕ ਉੱਥੇ ਚੌਂਕ 'ਚ ਅਤੇ ਉਹਨਾਂ ਨੇ ਆਪਣੇ ਕੈਮਰਾਜ ਲਾਏ ਨੇ ਔਫਿਸਰਜ਼ ਹੁੰਦੇ ਨੇ ਪ੍ਰੋਪਰ ਟ੍ਰੈਫਿਕਿੰਗ ਹੁੰਦੀ ਹੈ ਅਤੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਗਰੂਕ ਕੀਤਾ ਜਾਂਦਾ ਹੈ ਕੀ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਅਤੇ ਹੋਰ ਇੱਥੇ ਬਾਕੀ ਐਂਟਰਟੇਨਮੈਂਟ ਸਾਈਡ ਵੀ ਕਾਫੀ ਡਿਵੈਲਪਮੈਂਟ ਹੋ ਚੁੱਕੀ ਹੋਈ ਹੈ ਜਿਵੇਂ ਲੋਕਾਂ ਦੇ ਘੁੰਮਣ ਲਈ ਕਾਫੀ ਸਾਰੀ ਜਗ੍ਹਾਵਾਂ ਹੈਗੀਆਂ ਨਹੀਂ ਨਹੀਂ ਮੈਮ ਦਿੱਕਤ ਤਾਂ ਹਰ ਸ਼ਹਿਰ 'ਚ ਹੁੰਦੀ ਹੈ ਬਸ ਇੰਨਾ ਹੈਗਾ ਕਿ ਉਹ ਦਿੱਕਤਾਂ ਨਾਲ ਹੀ ਕਰ ਸਕਦੇ ਹਾਂ ਉਹਨਾਂ ਨੂੰ ਟੈਕਟਿਲ ਕਰ ਸਕਦੇ ਹਾਂ ਬਟ ਇੰਨਾ ਨਹੀਂ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਦਿੱਕਤਾਂ 'ਚ ਰਹਿੰਦੇ ਪਏ ਹਾਂ ਆਮ ਪਾਰਟੀ ਦੇ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਸੁਧਾਰ ਆ ਗਿਆ ਓਕੇ ਜੀ ਥੈਂਕ ਯੂ ਮੈਮ